ਮੈਂ ਇੱਕ ਵੱਡੇ ਸਮੂਹ ਲਈ ਖਾਣਾ ਪਕਾਇਆ ਹੋਇਆ ਆਪਣੇ ਪਰਿਵਾਰ ਦੇ ਨਾਲ ਇੱਕ ਵਾਰ ਜਦੋਂ ਮੇਰੇ ਭਰਾ ਦਾ ਜਨਮਦਿਨ ਸੀ ਤਾਂ ਅਸੀਂ ਉਸਦਾ ਜਨਮਦਿਨ ਮਨਾਇਆ ਸੀ ਅਤੇ ਮੈਂ ਆਪਣੇ ਪੂਰੇ ਪਰਿਵਾਰ ਨੂੰ ਸੱਦਾ ਦਿੱਤਾ ਸੀ ਅਤੇ ਉਸਦੇ ਦੋਸਤ ਵੀ ਆਏ ਸੀ ਤਾਂ ਅਸੀਂ ਇਕੱਠੇ ਮਿਲ ਕੇ ਰੋਟੀ ਖਾਧੀ ਸੀ ਅਤੇ ਬਣਾਈ ਸੀ ਤਾਂ ਪੂਰੇ ਪਰਿਵਾਰ ਨੇ ਉਹਦੇ ਵਿੱਚ ਸਹਾਇਤਾ ਕੀਤੀ ਸੀ ਅਤੇ ਸਮੂਹ ਵਿੱਚ ਰਹਿਣਾ ਇੱਕ ਬਹੁਤ ਹੀ ਖੁਸ਼ੀ ਦੀ ਗੱਲ ਹੁੰਦੀ ਹੈ ਅੱਜ ਕੱਲ ਦੇ ਸਮੇਂ ਵਿੱਚ ਲੋਕ ਇਕੱਲੇ ਰਹਿਣਾ ਜ਼ਿਆਦਾ ਪਸੰਦ ਕਰਦੇ ਨੇ ਸਮੂਹ ਵਿੱਚ ਰਹਿਣ ਨਾਲੋਂ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਅਗਰ ਇਕੱਲੇ ਰਹਾਂਗੇ ਤਾਂ ਜ਼ਿਆਦਾ ਪ੍ਰਾਈਵੇਸੀ ਮਿਲ ਸਕਦੀ ਨਹੀਂ ਉਹਨਾਂ ਨੂੰ ਪਰ ਇਹ ਗੱਲ ਸਹੀ ਨਹੀਂ ਹੈ ਸਾਨੂੰ ਸਮੂਹ ਵਿੱਚ ਰਹਿਣਾ ਚਾਹੀਦਾ ਹੈ ਸਮੂਹ ਵਿੱਚ ਰਹਿਣ ਨਾਲ ਪਿਆਰ ਵੱਧਦਾ ਹੈ ਅਤੇ ਸਮੂਹ ਵਿੱਚ ਰਹਿਣ ਨਾਲ ਸਾਡਾ ਜਿਹੜਾ ਆਪਸੀ ਭਾਈਚਾਰਾ ਉਹ ਵੀ ਵੱਧਦਾ ਹੈ ਅਤੇ ਜਦੋਂ ਉਸਦਾ ਜਨਮਦਿਨ ਸੀ ਤਾਂ ਅਸੀਂ ਉਸਦੇ ਲਈ ਖਾਣਾ ਪਕਾਇਆ ਸੀ ਸਾਰੇ ਘਰਦਿਆਂ ਦੇ ਨਾਲ ਉਸਦੇ ਦੋਸਤਾਂ ਲਈ ਵੀ ਅਤੇ ਆਪਣੇ ਪੂਰੇ ਪਰਿਵਾਰ ਲਈ ਵੀ ਤਾਂ ਇਸ ਕੰਮ ਨੂੰ ਕਰਨ ਵਿੱਚ ਕਾਫੀ ਮਜ਼ਾ ਆਇਆ ਅਤੇ ਅਨੁਭਵ ਕਾਫੀ ਵਧੀਆ ਰਿਹਾ ਜਦੋਂ ਅਸੀਂ ਪੂਰੇ ਘਰਦਿਆਂ ਦੇ ਨਾਲ ਪੂਰੇ ਸਮੂਹ ਲਈ ਰੋਟੀ ਬਣਾਈ ਸੀ ਤਾਂ ਸਾਰੇ ਘਰਦਿਆਂ ਨੇ ਜਦੋਂ ਸਹਾਇਤਾ ਕਰ ਰਹੀ ਸੀ ਤਾਂ ਉਸ ਦੇ ਨਾਲ ਨਾਲ ਸਾਨੂੰ ਕਈ ਚੀਜ਼ਾਂ ਸਿੱਖਣ ਨੂੰ ਵੀ ਮਿਲੀਆਂ ਅਤੇ ਅਸੀਂ ਕਾਫੀ ਅਨੁਭਵ ਵਧੀਆ ਰਿਹਾ